ਸਾਡੇ ਇਲਾਕੇ ਦੇ ਨੇੜੇ ਕੁਝ ਪ੍ਰਾਈਵੇਟ ਅਤੇ ਕੁਝ ਸਰਕਾਰੀ ਸੰਸਥਾਵਾਂ ਹਨ ਜਿਹੜੀਆਂ ਕਿ ਉੱਚ ਸਿੱਖਿਆ ਕਰਵਾਈ ਜਾਂਦੀ ਹੈ ਜਿੱਥੇ ਜ਼ਿਆਦਾਤਰ ਜਿਹੜੀ ਕਾਲਜਾਂ ਦੇ ਵਿੱਚ ਆਮ ਤੌਰ 'ਤੇ ਪਲੱਸ ਟੂ ਤੋਂ ਬਾਅਦ ਬਾਰੇ ਜਿਹੜੇ ਸਾਡੇ ਬੀ ਏ ਐਮ ਬੀ ਏ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਐਮ ਏ ਕਰਵਾਈ ਜਾਂਦੀ ਹੈ ਮਾਸਟਰ ਆਫ ਆਰਟਸ ਅਤੇ ਪੀ ਐਚ ਡੀ ਵੀ ਕਰਵਾਈ ਜਾਂਦੀ ਹੈ

ਇਸ ਤੋਂ ਇਲਾਵਾ ਐਮ ਬੀ ਕੋਮ ਹੋ ਗਈ ਐਮ ਕੋਮ ਹੋ ਗਈ ਇਹ ਜਿਹੜੇ ਕੋਰਸ ਹੈ ਇਹ ਜ਼ਿਆਦਾਤਰ ਯੂਨੀਵਰਸਿਟੀਆਂ ਦੇ ਕਾਲਜ ਦੇ ਵਿੱਚ ਉਪਲਬਧ ਹਨ ਨਵੀਂ ਐਜੂਕੇਸ਼ਨ ਪੋਲਸੀ ਹੈ ਜਿਹੜੀ ਉਹਦੇ ਅਕੋਰਡਿੰਗ ਇੱਕ ਨਵਾਂ ਕੋਰਸ ਜਿਹੜਾ ਬੀ ਏ ਬੀ ਐਡ ਇੰਟੀਗਰੇਟਡ ਕੋਰਸ ਹੈ ਇਹ ਵੀ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਯੂਨੀਵਰਸਿਟੀਆਂ ਅਤੇ ਕੋਲਜਾਂ ਦੇ ਵਿੱਚ ਸ਼ੁਰੂ ਹੋਇਆ ਗਾ ਇਸ ਦੇ ਤਹਿਤ ਬੱਚਿਆਂ ਨੂੰ ਜਿਹੜਾ ਬੀ ਏ ਬੀ ਐਡ ਦੋਵਾਂ ਤਰ੍ਹਾਂ ਦੇ ਇਕੱਠੇ ਕੋਰਸ ਕਰਵਾਏ ਜਾਂਦੇ ਹਨ ਅਤੇ ਇਹ ਜਿਹੜੇ ਸਾਰੇ ਕੋਰਸ ਹੈ ਨੇੜੇ ਦੇ ਸਾਡੇ ਕੋਲਜਾਂ ਦੇ ਵਿੱਚ ਉਪਲਬਧ ਹਨ